ਮੈਂ ਭੰਗੜੇ ਵਿੱਚ ਕੋਈ ਕਲਾਸਾਂ ਨਹੀਂ ਲਗਾਈਆ ਅਤੇ ਮੈਨੂੰ ਅਨੁਭਵ ਨਹੀਂ ਹੈ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਹੈਗਾ ਮੈਂ ਕੋਈ ਇਸ ਬਾਰੇ ਸਾਂਝਾ ਨਹੀਂ ਕਰ ਸਕਦੀ